ਹੈਲੋ ਹਾਂਜੀ ਫਲਿੱਪ ਫਲਿੱਪਕਾਡ ਤੋਂ ਬੋਲ ਰਹੇ ਹੋ ਜੀ ਹਾਂਜੀ ਸਰ ਜੋ ਪਿਛਲੇ ਹਫਤੇ ਮੈਂ ਤੁਹਾਡੇ ਤੋਂ ਕਿਤਾਬਾਂ ਓਡਰ ਕੀਤੀਆਂ ਸੀਗੀਆਂ ਈ ਬੁੱਕਸ ਕੀਤੀਆਂ ਸੀਗੀਆਂ ਉਹ ਸਾਰੀਆਂ ਸਰ ਮੈਨੂੰ ਮਿਲ ਗਈਆਂ ਸੀਗੀਆਂ ਟਾਈਮਲੀ ਅਤੇ ਉਹ ਸਾਰੀਆਂ ਦੀ ਪੈਕਿੰਗ ਬਹੁਤ ਵਧੀਆ ਸੀਗੀ ਅਤੇ ਜਿਹੜੀਆਂ ਤੁਹਾਡੀਆਂ ਬੁੱਕਸ ਸੀਗੀਆਂ ਉਹਦਾ ਮਟੀਰੀਅਲ ਵੀ ਸਾਰਾ ਵਧੀਆ ਸੀਗਾ ਜੀ ਥੈਂਕ ਊ ਜੀ ਉਹਦੇ ਨਾਲ ਮੇਰਾ ਬਹੁਤ ਸਹਿਯੋਗ ਹੋਇਆ ਕਿਉਂਕਿ ਮੇਰਾ ਜੋ ਪੇਪਰ ਹੈ ਉਹਦੀ ਮੈਂ ਤਿਆਰੀ ਚੰਗੀ ਤਰ੍ਹਾਂ ਕਰ ਸਕਾਂਗਾ